ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਦੱਸੋ ਜੀ ਹਾਂਜੀ ਮੈਮ ਓਕੇ ਮੈਮ ਹਾਂਜੀ ਹਾਂਜੀ ਮੈਮ ਘਰ ਵੀ ਟਿਊਸ਼ਨ ਰੱਖੇ ਹੋਏ ਨੇ ਹਾਂਜੀ ਹਾਂਜੀ ਮੈਮ ਸਹੀ ਕਹਿ ਰਹੇ ਹੋ ਤੁਸੀਂ ਹਾਂਜੀ ਮੈਮ ਵੈਸੇ ਆ ਸਾਡੇ ਵੱਲੋਂ ਹੋ ਰਿਹਾ ਹੈ ਤੁਸੀਂ ਵੀ ਆਪਣਾ ਧਿਆਨ ਰੱਖੋ ਥੋੜ੍ਹਾ ਬੱਚਿਆਂ ਵੱਲ ਤੁਹਾਡੇ ਬੱਚੇ ਹੀ ਨੇ ਜੀ ਇਵੇਂ ਸਮਝੋ ਅਤੇ ਸਾਡੇ ਅਸੀਂ ਟਿਊਸ਼ਨ ਰੱਖੇ ਹੋਏ ਨੇ ਬਾਕੀ ਆਉਂਦੇ ਹਾਂ ਸਰ ਮੈਮ ਆਉਂਦੇ ਹਾਂ ਸਕੂਲ 'ਚ ਕਿਸੇ ਦਿਨ ਮਿਲ ਕੇ ਜਾਂਦੇ ਆ ਮੈਮ ਤੁਹਾਨੂੰ ਹਾਂਜੀ ਹਾਂਜੀ ਮੈਮ ਹਾਂਜੀ ਹਾਂਜੀ ਮੈਮ ਉਹ ਤਾਂ ਸਮਝਾਂਦੇ ਰਹਿੰਦੇ ਹਾਂ ਥੋੜ੍ਹਾ ਜਾ

ਠੀਕ ਹੈ ਮੈਮ ਓਕੇ ਮੈਮ